ਬਹੁਤ ਦੂਰਾਂ ਤੋਂ ਲੋਕ ਆਪਣਾ ਯਾਤਰਾ ਕਰਨਾ ਆਉਂਦੇ ਨੇ ਤੇ ਇਹਦੇ ਨਾਲ ਹੀ ਇੱਕ ਆਪਣਾ ਜੈਨ ਮੰਦਰ ਏ ਜੋ ਕੀ ਜੈਨ ਮੰਦਰ ਅਸੀਂ ਜੋ ਕੀ ਪੁਰਾਣਾ ਮੰਦਰ ਹੈ ਤਾਂ ਕੀ ਜਿਹੜੇ ਵੀ ਆਪਣਾ ਜੈਨੀ ਹਨ ਉਹ ਇੱਥੇ ਆਉਂਦੇ ਨੇ ਤੇ ਨਮਸਕਾਰ ਆਪਣਾ ਕਰਦੇ ਨੇ ਤੇ ਉਸਦੇ ਨਾਲ ਹੀ ਰੋਜਾ ਸ਼ਰੀਫ ਹੈ ਰੋਜਾ ਸ਼ਰੀਫ ਦੇ ਅੰਦਰ ਜਿਹੜੇ ਆਪਣੇ ਮੁਸਲਮਾਨ ਭਰਾ ਨੇ ਉਹ ਆਉਂਦੇ ਨੇ ਆਪਣੀ ਹੱਜ ਆਪਣਾ ਕਰਦੇ ਨੇ ਅਤੇ ਜੋ ਸਾਡਾ ਇੱਕ ਧਾਰਮਿਕ ਵੀ ਆਪਣਾ ਕੇਂਦਰ ਹੈ ਜੋ ਕਿ ਫਤਿਹਗੜ੍ਹ ਸਾਹਿਬ ਦੇ ਅੰਦਰ ਅਜਿਹੀਆਂ ਤਿੰਨ ਅਸਥਾਨ ਹਨ ਜੈਨ ਮੰਦਰ ਜੋਤੀ ਸਰੂਪ ਰੋਜ਼ਾ ਸ਼ਰੀਫ ਇਹ ਤਿੰਨੋਂ ਅਸਥਾਨ ਅਵਿਆਦਾ ਦੇ ਸਥਾਨ ਨੇ ਆਪਣਾ ਜਿੱਥੇ ਹਰੇਕ ਬੰਦਾ ਆ ਕੇ ਯਾਤਰਾ ਆਪਣਾ ਕਰਦਾ ਹੈ